ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਕਿੱਥੇ ਹੋ ਨਹੀਂ ਤੁਸੀਂ ਤਾਂ ਮੈਨੂੰ ਕਿਤੇ ਦਿਖ ਨਹੀਂ ਰਹੇ ਨਹੀਂ ਨਹੀਂ ਮੈਂ ਤਾਂ ਉੱਥੇ ਖੜੀ ਹਾਂ ਤੁਸੀਂ ਹੈ ਨਹੀਂ ਉੱਥੇ ਹਾਂਜੀ ਨਹੀਂ ਤੁਸੀਂ ਖੜ੍ਹੇ ਕਿੱਥੇ ਹੋ ਮਤਲਬ ਐਡਰੈਸ ਦੱਸੋ ਨਾ ਆਪਣਾ ਕਿੱਥੇ ਖੜ੍ਹੇ ਕਿੱਥੇ ਹੋ ਕਰਿਆਨੇ ਦੀ ਦੁਕਾਨ ਨਹੀਂ ਨਹੀਂ ਇੱਥੇ ਤਾਂ ਕੋਈ ਕਰਿਆਨੇ ਦੀ ਦੁਕਾਨ ਨਹੀਂ ਹੈ ਤੁਸੀਂ ਗਲਤ ਐਡਰੈਸ 'ਤੇ ਚੱਲ ਗਏ ਹੋ ਹਾਂਜੀ ਚੱਲੋ ਮੈਂ ਤੁਹਾਨੂੰ ਐਡਰੈਸ ਦੱਸਦੀ ਹਾਂ ਹਾਂਜੀ ਤੁਸੀਂ ਤੁਸੀਂ ਬਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਸਾਹਮਣੇ ਵਾਲੀ ਗਲੀ ਆ ਹਾਂਜੀ ਬਸ ਉੱਥੋਂ ਖੱਬੇ ਹੱਥ ਮੁੜ ਜਾਓ ਹਾਂਜੀ ਸਿੱਧਾ ਸਿੱਧਾ ਆਈ ਚੱਲੋ ਹਾਂਜੀ ਚੱਲੋ ਇੱਕ ਕੰਮ ਕਰੋ ਅਗਰ ਤੁਹਾਨੂੰ ਨਹੀਂ ਵੀ ਪਤਾ ਲੱਗਦਾ ਨਾ ਤਾਂ ਮੈਂ ਤੁਸੀਂ ਕੋਲ 'ਤੇ ਰਿਹੋ ਮੈਂ ਤੁਹਾਨੂੰ ਗਾਈਡ ਕਰਦੀ ਹਾਂ ਹਾਂਜੀ ਠੀਕ ਠੀਕ ਹਾਂਜੀ ਉਹਤੋਂ ਸੱਜੇ ਸੱਜੇ ਸੱਜੇ ਹੱਥ ਹੋ ਜਾਓ ਭਾਅ ਜੀ ਉੱਥੋਂ ਠੀਕ ਆ ਹਾਂਜੀ ਹੁਣ ਸਿੱਧਾ ਹਾਂਜੀ ਹਾਂਜੀ ਮੈਂ ਆਉਂਦੀ ਪਈ ਹਾਂ ਅੱਗੋਂ ਬਸ ਅੱਗੇ ਆਣਗੇ ਹੁਣ ਹਾਂਜੀ ਅੱਗੋਂ ਖੱਬੇ ਹੋ ਜਾਓ ਠੀਕ ਚਾਰ ਘਰ ਛੱਡ ਕੇ ਇੱਕ ਬਲੈਕ ਕਲਰ ਦਾ ਗੇਟ ਹੋਣਾ ਵਾ ਹਾਂਜੀ ਬਸ ਉਹਦੇ ਉਹਦੇ ਸਾਹਮਣੇ ਹਾਂਜੀ ਉਹ ਹਾਂਜੀ ਭਾਅ ਜੀ ਆਹ ਅਸੀਂ ਖੜ੍ਹੇ ਹਾਂ ਠੀਕ ਹੈ ਧੰਨਵਾਦ